ਕਿਵੇਂ ਹੋ ਵਧੀਆ ਅਤੇ ਅੱਜ ਕੱਲ੍ਹ ਕੀ ਕਰਦੇ ਹੁੰਦੇ ਹੋ

ਮੈਂ ਪੁੱਛਣਾ ਸੀ ਵੀ ਮੈਨੂੰ ਵੀ ਕੋਈ ਇੰਸਟਰਕਸ਼ਨ ਦੇ ਦਿਓ ਵੀ ਮੈਂ ਲਿਖਦੀ ਹਾਂ ਬਟ ਮੇਰੇ ਤੋਂ ਧਿਆਨ ਨਹੀਂ ਲਗਾਇਆ ਜਾਂਦਾ ਜਾਂ ਲਿਖੀ ਨਹੀਂ ਜਾਂਦੀ ਸਹੀ ਤਰ੍ਹਾਂ ਹਾਂਜੀ

ਹਾਂਜੀ ਹਾਂ ਓਕੇ ਓਕੇ ਠੀਕ

ਠੀਕ ਹੈ ਠੀਕ ਹੈ ਇਹ ਮਤਲਬ ਆਪਾਂ ਕੌਨਸਟਰੇਸ਼ਨ ਲਈ ਕੀ ਕੀ ਕਰੀਏ ਉਹ ਦੱਸੋ

ਠੀਕ ਹੈ ਠੀਕ ਹੈ

ਠੀਕ ਹੈ ਠੀਕ ਹੈ ਠੀਕ ਹੈ ਠੀਕ ਓਕੇ ਓਕੇ ਅਤੇ ਮਤਲਬ ਕਿ ਕੋਈ ਠੀਕ ਹੈ ਓਕੇ ਠੀਕ ਹੈ ਹਾਂ ਲਿਖ ਰਹੇ ਹਾਂ ਕੋਈ ਸੈਲਫ ਕੋਨਫੀਡੈਂਸ 'ਤੇ ਰਹੇ ਹਾਂ ਅਤੇ ਮਤਲਬ ਉੱਦਾਂ ਕੋਈ ਮੈਡੀਟੇਸ਼ਨ ਵਗੈਰਾ ਦਾ ਕੋਈ ਜੇ ਯੋਗਾ ਵਗੈਰਾ ਦਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ ਠੀਕ ਹੈ ਠੀਕ ਹੈ ਹਾਂ ਮੇਰਾ ਬ੍ਰਦਰ ਹੈ ਬਟ ਕੋਈ ਗੱਲ ਨਹੀਂ ਉਹ ਤਾਂ ਮੈਂ ਦੇਖ ਲਾਂਗੀ ਕਿਵੇਂ ਮਤਲਬ ਮੈਨੇਜ ਕਰਲਾ ਕਿਉਂਕਿ ਉਹ ਤਾਂ ਬਾਹਰ ਰਹਿੰਦਾ ਨਾ ਤਾਂ ਕਰ ਕੇ ਹੂੰ ਠੀਕ ਹੈ ਓਕੇ ਥੈਂਕ ਯੂ ਠੀਕ ਹੈ ਜੀ ਓਕੇ